ਕੁੱਝ ਵਹਿਮਾਂ ਭਰਮਾਂ ਬਾਰੇ ਦੱਸੋ ਜਿਹਨਾਂ 'ਤੇ ਤੁਸੀਂ ਜਾਂ ਤੁਹਾਡੇ ਇਲਾਕੇ ਦੇ ਮੌਜੂਦ ਲੋਕ ਵਿਸ਼ਵਾਸ ਕਰਦੇ ਹਨ ਜਿਵੇਂ ਕਿ ਸਾਰੇ ਕਈ ਦੇ ਆਤਮਾ ਪ੍ਰੇਤਾਂ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਦੇ ਜਲ ਨਾਲ ਜਾਂ ਕਿਸੇ ਪੰਡਿਤ ਦੇ ਥਰੂ ਜਾ ਕੇ ਉਸ ਨੂੰ ਹੱਥ ਹੌਲਾ ਕਰਵਾ ਕੇ ਉਸਦੀ ਉਸ ਨੂੰ ਸਹੀ ਕਰਵਾਉਂਦੇ ਹਨ ਬੰਦੇ ਨੂੰ ਕਈ ਟੂਣਿਆਂ ਦੇ ਬਹੁਤ ਵਿਸ਼ਵਾਸ ਕਰਦੇ ਹਨ ਕਿਵੇਂ ਕਿ ਚੌਂਕਾਂ ਦੇ ਵਿੱਚ ਝਾੜੂ ਨੂੰ ਜਾਂ ਵਗੈਰਾ ਨਾਰੀਅਲ ਰੱਖ ਕੇ ਲੋਕ ਟੂਣੇ ਕਰਦੇ ਹਨ ਜਿਸ ਨਾਲ ਉਹ ਸੋਚਦੇ ਹਨ ਕਿ ਉਹਨਾਂ ਦਾ ਕੰਮ ਕਾਰ ਸਹੀ ਚੱਲੇਗਾ ਅਤੇ ਉਹਨਾਂ ਦਾ ਵਿਗੜਿਆ ਕੰਮ ਬਣ ਜਾਏਗਾ ਜੇ ਕਿਸੇ ਬੰਦੇ ਦਾ ਵਿਗੜਦਾ ਕੰਮ ਵਿਗਾੜਨ ਲਈ ਇਹ ਵਿੱਚ ਵੀ ਉਹ ਟੂਣੇ ਟੱਪੇ ਦਾ ਪ੍ਰਯੋਗ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਟੂਣਾ ਟੱਪਾ ਕਰਨ ਅਤੇ ਟੂਣਾ ਟੱਪਾ ਕਰਨ 'ਤੇ ਇਹ ਉਹਨਾਂ ਦਾ ਕੰਮ ਦੂਜੇ ਦਾ ਕੰਮ ਵਿਗਾੜ ਸਕਦੇ ਹਨ ਅਤੇ ਆਪਣਾ ਉਹ ਸਹੀ ਕਰ ਸਕਦੇ ਹਨ